ਹੈਲੋ ਹਾਂਜੀ ਭਾਅ ਜੀ ਹਰਚੇਤ ਟਰੈਵਲਸ ਤੋਂ ਗੱਲ ਕਰਦੇ ਪਏ ਭਾਅ ਜੀ ਮੈਂ ਨਾ ਕਪੂਰਥਲਾ ਮੈਨੂੰ ਮਾੜਾ ਜਿਹਾ ਪੁੱਛਣਾ ਸੀਗਾ ਇੱਧਰ ਘੁੰਮਣ ਵਾਸਤੇ ਜਗ੍ਹਾ ਵਗੈਰਾ ਦਾ ਪੁੱਛਣਾ ਸੀਗਾ ਤੁਹਾਡੇ ਕੋਲੋਂ ਅਤੇ ਤੁਸੀਂ ਘੁੰਮਾ ਸਕਦੇ ਮੈਨੂੰ ਇੱਧਰ ਉੱਧਰ ਕਿ ਜਗ੍ਹਾ ਟੈਂਪਲ ਅਤੇ ਗੁਰਦੁਆਰੇ ਵਗੈਰਾ ਤੁਸ ਭਾਅ ਜੀ ਤੁਸੀਂ ਤੁਸੀਂ ਜਾਓਗੇ ਮੇਰੇ ਨਾਲ ਮੈਂ ਤਾਂ ਨਵਾਂ ਆ ਨਾ ਤਾਂ ਮੈਨੂੰ ਬਸ ਰੇਟ ਵਗੈਰਾ ਤੁਸੀਂ ਦੱਸਿਓ ਤੁਹਾਡੀ ਘੁਮਾਉਣ ਵਗੈਰਾ ਦਾ ਰੇਟ ਕੀ ਹੈਗਾ

ਓਕੇ ਜੀ ਥੈਂਕਯੂ